ਪੰਜ ਜਨਵਰੀ ਉੱਨੀ ਸੌ ਅਠਾਨਵੇਂ ਸੱਤ ਅਕਤੂਬਰ ਦੋ ਹਜ਼ਾਰ ਅੱਠ ਅਗਸਤ ਦੋ ਹਜ਼ਾਰ ਦੋ ਨੌ ਜਨਵਰੀ ਦੋ ਹਜ਼ਾਰ ਸੱਤ ਅਤੇ ਗਿਆਰਾਂ ਦਸੰਬਰ ਦੋ ਹਜ਼ਾਰ ਗਿਆਰਾਂ